ਹਾਂ ਮੈਂ ਕਿਸਾਨਾਂ ਦੀ ਖੁਦਕੁਸ਼ੀ ਬਾਰੇ ਬਿਲਕੁਲ ਆਪਣੇ ਵਿਚਾਰ ਸਾਂਝੇ ਕਰਨੇ ਚਾਹਾਂਗੀ ਇਸ ਦੇ ਪਿੱਛੇ ਕਾਰਣ ਕੀ ਹੈ ਕਿ ਮੈਂ ਖੁਦ ਇੱਕ ਕਿਸਾਨ ਪਰਿਵਾਰ ਨਾਲ ਸੰਬੰਧਿਤ ਹਾਂ ਤਾਂ ਕਿਸਾਨ ਜੋ ਖੁਦਕੁਸ਼ੀਆਂ ਕਰ ਰਹੇ ਹਨ ਤਾਂ ਉਹਨਾਂ ਦਾ ਜੋ ਦਰਦ ਹੈ ਮੈਂ ਆਪਣੇ ਅੱਖੀਂ ਦੇਖਿਆ ਹੈ ਉਹ ਦੁੱਖ ਮੈਂ ਖੁਦ ਮਹਿਸੂਸ ਕੀਤਾ ਹੈ ਤਾਂ ਇਸ ਲਈ ਆਪਣੇ ਵਿਚਾਰ ਸਾਂਝੇ ਕਰਨੇ ਮੈਂ ਇੱਥੇ ਜ਼ਰੂਰੀ ਸਮਝਦੀ ਹਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਕਰਨ ਦੇ ਪਿੱਛੇ ਇੱਕ ਮੁੱਖ ਕਾਰਣ ਕਰਜ਼ਾ ਹੈ ਅ ਫਸਲਾਂ ਅੱਜ ਕੱਲ੍ਹ ਜੋ ਹਨ ਬਹੁਤੀਆਂ ਨਹੀਂ ਹੋ ਰਹੀਆਂ ਫਸਲਾਂ ਦੇ ਝਾੜ ਮਾੜੇ ਹਨ ਚਾਹੇ ਮਾਲਵੇ ਇਲਾਕੇ ਦੇ ਵਿੱਚ ਦੇਖਿਆ ਜਾਵੇ ਤਾਂ ਨਰਮਾ ਕਪਾਹ ਕਣਕ ਚਾਹੇ ਕੋਈ ਵੀ ਫਸਲ ਹੈ ਪਿਛਲੇ ਲਗਭਗ ਤਿੰਨ ਚਾਰ ਸਾਲਾਂ ਤੋਂ ਤਾਂ ਬਹੁਤ ਹੀ ਘੱਟ ਹੋ ਰਹੀਆਂ ਹਨ ਜਿਸ ਕਾਰਣ ਕਰਜ਼ੇ ਦਾ ਜੋ ਬੋਝ ਹੈ ਉਹਨਾਂ ਦੇ ਸਿਰ 'ਤੇ ਦਿਨੋ ਦਿਨ ਵੱਧ ਰਿਹਾ ਹੈ ਜਦੋਂ ਇਸ ਕਰਜ਼ੇ ਤੋਂ ਮੁਕਤੀ ਨਹੀਂ ਹੋ ਪਾਉਂਦੀ ਸਰਕਾਰਾਂ ਕੋਈ ਮਦਦ ਨਹੀਂ ਕਰ ਪਾਉਂਦੀਆਂ ਕੋਈ ਕਰਜ਼ਾ ਮਾਫ ਨਹੀਂ ਕੀਤਾ ਜਾਂਦਾ ਕਰਜ਼ੇ ਦੀਆਂ ਕੁਝ ਦਰਾਂ ਮਾਫ ਨਹੀਂ ਕੀਤੀਆਂ ਜਾਂਦੀਆਂ ਤਾਂ ਕਿਸਾਨਾਂ ਦੇ ਸਾਹਮਣੇ ਆਪਣੀ ਸਮੱਸਿਆ ਦਾ ਇੱਕੋ ਹੀ ਹੱਲ ਬਚ ਜਾਂਦਾ ਹੈ ਅਤੇ ਉਹ ਹੱਲ ਹੈ ਖੁਦਕੁਸ਼ੀ ਕਿਸਾਨ ਅਖੀਰ ਨੂੰ ਰੱਸਿਆਂ ਨੂੰ ਆਪਣੇ ਗਲਾਂ ਵਿੱਚ ਪਾ ਲੈਂਦੇ ਹਨ ਜਾਂ ਫਿਰ ਸਪਰੇ ਵਗੈਰਾ ਪੀ ਕੇ ਆਪਣੀ ਜਾਨ ਦੇ ਦਿੰਦੇ ਹਨ ਇਸ ਦਾ ਖਾਮਿਆਜਾ ਜਿਹੜਾ ਹੈ ਉਹ ਕਿਸਾਨਾਂ ਦੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ ਉਹਨਾਂ ਦੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ ਹਾਂ ਇਹਦੇ ਵਿੱਚ ਸਰਕਾਰ ਬਿਲਕੁਲ ਯੋਗ ਕਦਮ ਚੁੱਕ ਸਕਦੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਜ਼ਰੂਰਤਮੰਦ ਕਿਸਾਨ ਹਨ ਜਿੱਥੋਂ ਤੱਕ ਹੋ ਸਕੇ ਜਿੱਥੋਂ ਤੱਕ ਰਾਜ ਦਾ ਖਜ਼ਾਨਾ ਮਤਲਬ ਆਗਿਆ ਦਿੰਦਾ ਹੈ ਤਾਂ ਕਿਸਾਨਾਂ ਦਾ ਜਿਹੜਾ ਕਰਜ਼ਾ ਹੈ ਉਹ ਮਾਫ ਕਰ ਦੇਣਾ ਚਾਹੀਦਾ ਹੈ ਜੇਕਰ ਸਾਰਾ ਕਰਜ਼ਾ ਨਹੀਂ ਵੀ ਮਾਫ ਹੋ ਰਿਹਾ ਤਾਂ ਉਹਦੇ ਵਿੱਚੋਂ ਕੁਝ ਨਾ ਕੁਝ ਪ੍ਰਤੀਸ਼ਤ ਰਿਆਇਤ ਦੇਣੀ ਚਾਹੀਦੀ ਹੈ ਕੁਝ ਨਾ ਕੁਝ ਪ੍ਰਤੀਸ਼ਤ ਰਿਆਇਤ ਦੇਣ 'ਤੇ ਵੀ ਕਿਸਾਨਾਂ ਦਾ ਜਿਹੜਾ ਬੋਝ ਹਲਕਾ ਹੋ ਸਕਦਾ ਹੈ ਤਾਂ ਸਰਕਾਰ ਨੂੰ ਇਸ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਦੂਜਾ ਕਾਰਣ ਬੇਰੁਜ਼ਗਾਰੀ ਹੈ ਕਿਉਂਕਿ ਆਮ ਕਰਕੇ ਦੇਖਿਆ ਗਿਆ ਹੈ ਕਿ ਜੋ ਕਿਸਾਨ ਪਰਿਵਾਰ ਹਨ ਉਹਨਾਂ ਦੀ ਆਮਦਨ ਦਾ ਸਾਧਨ ਸਿਰਫ਼ ਖੇਤੀਬਾੜੀ ਹੁੰਦਾ ਹੈ ਕੋਈ ਨੌਕਰੀਆਂ ਵਗੈਰਾ ਨਹੀਂ ਹੁੰਦੀਆਂ ਤਾਂ ਬੇਰੁਜ਼ਗਾਰੀ ਦਾ ਦੌਰ ਚੱਲ ਰਿਹਾ ਹੈ ਅਜਿਹੇ ਦੌਰ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਅਤੇ ਬੱਚਿਆਂ ਨੂੰ ਅੱਗੇ ਨੌਕਰੀਆਂ ਵੀ ਨਹੀਂ ਮਿਲਦੀਆਂ ਤਾਂ ਅਜਿਹੇ ਵਿੱਚ ਬੱਚੇ ਨੂੰ ਜੇ ਪੜਾ ਪੜ੍ਹਾਉਂਦੇ ਹਨ ਅਤੇ ਉਹਨਾਂ ਦਾ ਖਰਚਾ ਅੱਗੇ ਨਹੀਂ ਉਠਾ ਸਕਦੇ ਤਾਂ ਕਿਸਾਨ ਜਿਹੜੇ ਨੇ ਖੁਦਕੁਸ਼ੀਆਂ ਕਰ ਸਕਦੇ ਹਨ ਤਾਂ ਸਰਕਾਰ ਨੂੰ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਨਿਮਨ ਵਰਗ ਦੇ ਨਿਮਨ ਤਪਕੇ ਦੇ ਕਿਸਾਨ ਹਨ ਉਹਨਾਂ ਦੇ ਬੱਚਿਆਂ ਦੀਆਂ ਪੜ੍ਹਾਈਆਂ ਦੇ ਵਿੱਚ ਵੀ ਸਰਕਾਰ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਕਿਤੇ ਨਾ ਕਿਤੇ ਮੁਫ਼ਤ ਵਿਦਿਆ ਕੁਝ ਪ੍ਰਤੀਸ਼ਤ ਜੋ ਹੈ ਦੇਣੀ ਚਾਹੀਦੀ ਹੈ